ਸਤਿ ਸ਼੍ਰੀ ਅਕਾਲ ਭਾਅ ਜੀ ਆਪਣਾ ਦੀਪ ਟੂਰ ਐਂਡ ਟਰੈਵਲਸ ਤੋਂ ਬੋਲ ਰਹੇ ਹੋ ਅੰਮ੍ਰਿਤਸਰ ਤੋਂ ਹਾਂਜੀ ਭਾਅ ਜੀ ਮੈਂ ਨਾ ਇੱਕ ਕੈਬ ਲਈ ਸੀ ਅੱਜ ਤੋਂ ਹਫਤਾ ਕੁ ਪਹਿਲਾਂ ਅਤੇ ਆਪਣੇ ਆਏ ਸੀਗੇ ਹਰਮੀਤ ਭਾਅ ਜੀ ਆਏ ਸੀਗੇ ਅਤੇ ਲੈ ਕੇ ਗਏ ਸੀਗੇ ਸਾਨੂੰ ਗੁਰਦੁਆਰਿਆਂ ਦੀ ਯਾਤਰਾ ਲਈ ਅਤੇ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਸੀਗਾ ਅਤੇ ਮੇਰੇ ਕੋਲ ਉਹਨਾਂ ਦਾ ਨੰਬਰ ਪਲੀਜ਼ ਮਿਸਪਲੇਸ ਹੋ ਗਿਆ ਅਤੇ ਕੀ ਮੈਂ ਉਹਨਾਂ ਦਾ ਨੰਬਰ ਲੈ ਸਕਦਾ ਤੁਹਾਡੇ ਕੋਲੋਂ ਉਹਨਾਂ ਕੋਲ ਗੱਡੀ ਸੀਗੀ ਹੋਂਡਾ ਮੇਜ਼ ਅਤੇ ਅਸੀਂ ਚਾਰ ਲੋਕ ਸੀਗੇ ਹੁਣ ਮੇਰੀ ਫੈਮਿਲੀ ਆ ਰਹੀ ਹੈ ਬਾਹਰੋਂ ਅਤੇ ਅਸੀਂ ਹੁਣ ਗੱਡੀ ਵੱਡੀ ਚਾਹੁੰਦੇ ਹਾਂ ਅਤੇ ਤੁਸੀਂ ਪਲੀਜ਼ ਇੱਦਾਂ ਕਰੋ ਕਿ ਵੀ ਗੱਡੀ ਸਾਨੂੰ ਵੱਡੀ ਚਾਹੀਦੀ ਹੈ ਅਤੇ ਉਸ ਹਿਸਾਬ ਨਾਲ ਸਾਨੂੰ ਬੰਦੇ ਦਾ ਨੰਬਰ ਜਿਹੜਾ ਉਹ ਸੈਂਡ ਕਰ ਦਿੱਤਾ ਜਾਵੇ ਅਸੀਂ ਇੱਥੋਂ ਦੀ ਜਾਣਾ ਚਾਹੁੰਦੇ ਹਾਂ ਜੀ ਪਹਿਲਾਂ ਚੰਡੀਗੜ੍ਹ ਉੱਥੇ ਕੁਛ ਸ਼ੋਪਿੰਗ ਕਰਨੀ ਹੈ ਚੰਡੀਗੜ੍ਹ ਤੋਂ ਸਾਰਾ ਸਾਡਾ ਉੱਥੇ ਇੱਕ ਇਵੈਂਟ ਹੈ ਰਾਤ ਦਾ ਅਸੀਂ ਉਸ ਚੀਜ਼ ਨੂੰ ਦੇਖ ਕੇ ਰਿਸੈਪਸ਼ਨ ਹੈ ਰਿਸੇਪਸ਼ਨ ਅਟੈਂਡ ਕਰਕੇ ਰਾਤ ਉੱਥੇ ਸਟੇਅ ਕਰਕੇ ਨੈਕਸਟ ਡੇ ਅਸੀਂ ਜਾਣਾ ਚਾਹਵਾਂਗੇ ਕੁੱਲੂ ਕੁੱਲੂ ਕੁੱਲੂ ਅਸੀਂ ਉੱਥੇ ਪਹੁੰਚ ਗਏ ਜੀ ਅਤੇ ਸਟੇਅ ਕਰਕੇ ਉੱਥੇ ਦੋ ਕੁ ਦਿਨ ਦਾ ਅਤੇ ਫਿਰ ਵਾਪਸ ਅਸੀਂ ਅੰਮ੍ਰਿਤਸਰ ਆਉਣਾ ਚਾਹੁੰਦੇ ਹਾਂ ਮੇਰੀ ਜਿਹੜੀ ਫੈਮਿਲੀ ਆ ਉਹ ਬਾਹਰੋਂ ਆ ਰਹੀ ਅਤੇ ਪਲੀਜ਼ ਬੰਦਾ ਉਹ ਹੀ ਭੇਜਣਾ ਬਟ ਇਸ ਵਾਰੀ ਗੱਡੀ ਜਿਹੜੀ ਆ ਉਹਨੂੰ ਕਹਿਣਾ ਕਿ ਵੀ ਮੈਂਬਰ ਜ਼ਿਆਦਾ ਨੇ ਅਤੇ ਗੱਡੀ ਥੋੜ੍ਹੀ ਵੱਡੀ ਲੈ ਕੇ ਆਵੇ ਇਨੋਵਾ ਲੈ ਆਵੇ ਫੋਰਚੂਨਰ ਲੈ ਆਵੇ ਠੀਕ ਹੈ ਜੀ ਅਤੇ ਉਹਨਾਂ ਨੂੰ ਤੁਸੀਂ ਭੇਜਣਾ ਅਤੇ ਅਸੀਂ ਮੈਨੂੰ ਨੰਬਰ ਸੈਂਡ ਕਰ ਦੇਣਾ ਜੀ ਉਹਨਾਂ ਦਾ